ਹੈਲੋ ਹਾਂਜੀ ਕੌਣ ਬੋਲਦੇ ਜੀ ਠੀਕ ਆ ਜੀ ਅਤੇ ਅਸੀਂ ਬੈਡ ਬਣਾਉਣਾ ਸੀਗਾ ਕਿਸ ਤਰ੍ਹਾਂ ਦੀ ਲੱਕੜ ਲਾਉਂਦੇ ਆ ਤੁਸੀਂ ਹਾ ਬਾ ਬੋਕਸ ਬੈਡ ਬਣਾਉਣਾ ਨਾਲ ਉਹ ਬਕਸੇ ਵੀ ਬਣਾਉਣੇ ਬੈੱਡ ਦੇ ਬੋਕਸ ਬਣਾ ਦੋਂਗੇ ਅੱਛਾ ਅਤੇ ਹੋਰ ਬੈਂਚ ਵਗੈਰਾ ਅੱਛਾ ਅਤੇ ਠੀਕ ਕੀ ਕੀ ਕਿਹੜੀ ਲੱਕੜ ਲਾਉਂਦੇ ਹੈ ਤੁਸੀਂ ਬਕਸ ਬ ਬੋਕਸ ਬੈੱਡ ਨੂੰ ਚੀ ਚੀਲ ਦੀ ਅੱਛਾ ਪਲਾਈ ਪਲੁਈ ਵਧੀਆ ਲਾਉਂਦੇ ਆ ਸਰਮਾਈ ਸਰਮਾਈਖਾ ਲਾ ਕੇ ਬੋਕਸ ਕਿੰਨੇ ਇੰਚ ਕੁ ਸੱਤ ਫੁੱਟ ਦਾ ਬੈੱਡ ਬਣਾਉਣੇ ਓਂ ਬਣਾਓਂਗੇ ਠੀਕ ਆ ਅਸੀਂ ਤੁਹਾਡੇ ਕੋਲ ਆਵਾਂਗੇ ਅਸੀਂ ਤੁਹਾਡੇ ਕੋਲ ਆਵਾਂਗੇ ਅਤੇ ਤੁਸੀਂ ਯਾਨੀ ਸਾਨੂੰ ਉਹ ਦੱਸਿਓ ਵੀ ਕੀ ਕੀ ਡ ਕਿਹੜੇ ਕਿਹੜੇ ਡਿਜ਼ਾਇਨ ਬਣਾਉਂਦੇ ਆ ਅਸੀਂ ਪੁ ਤੁਹਾਡੇ ਤੋਂ ਪਤਾ ਕਰਾਂਗੇ ਠੀਕ ਆ ਠੀਕ ਆ ਅਸੀਂ ਕੱਲ੍ਹ ਪਰਸੋਂ ਤੱਕ ਤੁਹਾਡੇ ਕੋਲ ਆਵਾਂਗੇ ਕੀ ਰੇਟ ਰੂਟ ਚੱਲਦੇ ਆ ਤੁਹਾਡੇ ਠੀਕ ਆ ਠੀਕ ਆ ਠੀਕ ਆ ਅਸੀਂ ਤੁਹਾਡੇ ਕੋਲ ਕੱਲ੍ਹ ਜਾਂ ਪਰਸੋਂ ਤੱਕ ਆਵਾਂਗੇ ਅਤੇ ਫਿਰ ਵੇਖ ਕੇ ਤੁਹਾਡਾ ਯਾਨੀ ਕੰਮ ਅਤੇ ਅਸੀਂ ਤੁਹਾਨੂੰ ਸਾਈ ਫੜ੍ਹਾ ਜਾਵਾਂਗੇ ਅਤੇ ਫਿਰ ਚੇ ਚੇਅਰ ਕੁਰਸੀਆਂ ਵੀ ਬਣਾ ਦਿੰਦੇ ਆ ਠੀਕ ਹੈ ਕੁਰਸੀਆਂ ਦੇ ਕੀ ਕੀ ਰੇਟ ਹੋਣਗੇ ਸ ਸੈੱਟ ਸੈਟ ਸੈੱਟ ਬਣਾਉਂਦੇ ਆ ਕਿ ਕਿਵੇਂ ਸ ਸਿੰਗਲ ਸਿੰਗਲ ਦਾ ਕੀ ਸਿੰਗਲ ਦਾ ਠੀਕ ਹੈ ਚਲੋ ਠੀਕ ਆ ਅਸੀਂ ਤੁਹਾਡੇ ਕੋਲ ਆਵਾਂਗੇ ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਪਲਾਈ ਪਲਾਈ ਵਧੀਆ ਲਾਇਓ ਜੇ ਸਾਡੇ ਬੈੱਡ 'ਤੇ ਬੋਕਸ ਬੋਕਸ ਬੈੱਡ ਵੀ ਯਾਨੀ ਚਾਹੀਦਾ ਚੰਗਾ ਅਤੇ ਬਾਕੀ ਛੋਟੇ ਸਟੂਲ ਬਣਾਉਂਦੇ ਆ ਠੀਕ ਹੈ ਠੀਕ ਹੈ ਕਿ ਤੁਹਾਡੀ ਦੁਕਾਨ ਕਿੱਥੇ ਕੁ ਰਹਿ ਜਾਂਦੀ ਹੈ ਪਸ਼ੀਨਾ ਰੋਡ ਅੱਛਾ ਬਾਏਪਾਸ ਠੀਕ ਆ ਅਸੀਂ ਜ਼ਰੂਰ ਅ ਆਵਾਂਗੇ ਕੱਲ੍ਹ ਪਰਸੋਂ ਤੱਕ ਕਦੋਂ ਕਦੋਂ ਅੱਜ ਠੀਕ ਆ ਥੋੜ੍ਹਾ ਜਿਹਾ ਸਾਨੂੰ ਟੈਮ ਦੱਸ ਦਿਓ ਤੁਸੀਂ ਦੁਕਾਨ 'ਤੇ ਕਿਸ ਕੁ ਟਾਈਮ ਤੱਕ ਹੋਓਂਗੇ ਅੱਠ ਕੁ ਵਜੇ ਆ ਜਾਂਦੇ ਆ ਨੌਂ ਕੁ ਵਜੇ ਖੋਲ੍ਹਦੇ ਚਲੋ ਅਸੀਂ ਕੁ ਆਵਾਂਗੇ ਤੁਹਾਡੇ ਕੋਲ ਨਾਲੇ ਤੁਹਾਨੂੰ ਤੁਹਾਡਾ ਨੰਬਰ ਤੁਸੀਂ ਦੇ ਦਿਓ ਸਾਨੂੰ ਆਪਣਾ ਅਤੇ ਠੀਕ ਹੈ ਠੀਕ ਹੈ ਜੀ